ਪਿੰਡਾਂ ਵਿੱਚ ਬਹੁਤ ਸਾਰੀਆਂ ਖੇਡਾਂ ਖੇਡੀਆਂ ਜਾਂਦੀਆਂ ਹਨ ਜਿਵੇਂ ਕਿ ਕਬੱਡੀ ਕੁਸ਼ਤੀ ਰੱਸਾ ਖਿੱਚਣਾ ਪੀਚੋ ਬਾਂਦਰ ਕੀਲਾ ਪਿੱਠੂ ਗੀਟੇ ਆਦਿ ਖੇਡੇ ਜਾਂਦੇ ਹਨ ਇਹਨਾਂ ਨੂੰ ਖੇਡ ਕੇ ਅਸੀਂ ਬਹੁਤ ਖੁਸ਼ ਹੁੰਦੇ ਸੀ